ਮੈਂ ਦਿਕਸ਼ਾ ਗੁਰਦਸਪੁਰ ਜਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਇਹ ਦੱਸਣਾ ਚਾਹੁੰਦੀ ਹਾਂ ਕਿ ਵਿਗਿਆਨ ਅਤੇ ਟੈਕਨੋਲੋਜੀ ਨੇ ਵਾਤਾਵਰਣ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਾਡੀ ਕਿਵੇਂ ਮਦਦ ਕੀਤੀ ਹੈ ਤਾਂ ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਸਾਡੇ ਵਿਗਿਆਨਿਕਾਂ ਨੇ ਹੀ ਚੰਦਰਮਾ ਅਤੇ ਮੰਗਲ ਗ੍ਰਹਿ ਤੱਕ ਦੀ ਯਾਤਰਾ ਤੈਅ ਕੀਤੀ ਹੈ ਬਟ ਇਹ ਸਭ ਜੋ ਹੈ ਇੱਕ ਟੈਕਨੋਲੋਜੀ ਦੇ ਮੇਲ ਨਾਲ ਹੀ ਸੰਭਵ ਹੋ ਸਕਿਆ ਹੈ ਜੇ ਇਹ ਟੈਕਨੋਲੋਜੀ ਨਾ ਹੁੰਦੀ ਅਤੇ ਟੈਕਨੋਲਜੀ ਵਿਕਸਿਤ ਨਾ ਹੁੰਦੀ ਤਾਂ ਰੋਕਟ ਬਣਾਉਣਾ ਸੰਭਵ ਨਹੀਂ ਸੀ ਜਿਸ ਕਰਕੇ ਅਸੀਂ ਜੋ ਹੈ ਦੂਸਰੇ ਗ੍ਰਹਿਆਂ ਦੀ ਯਾਤਰਾ ਨਹੀਂ ਕਰ ਸਕਦੇ ਸੀ ਤਾਂ ਇਹ ਜੋ ਵੀ ਵਾਤਾਵਰਨ ਵਿੱਚ ਸਾਡੇ ਸੰਬੰਧਿਤ ਮੁੱਦੇ ਸਨ ਉਹ ਵਿਗਿਆਨ ਅਤੇ ਟੈਕਨੋਲੋਜੀ ਨੇ ਦੋਨਾਂ ਨੇ ਮਿਲ ਕੇ ਹੀ ਹੱਲ ਕੀਤੇ ਹਨ ਵਿਗਿਆਨ ਜਿਵੇਂ ਕੀ ਹੈ ਉਹ ਇਹ ਦੱਸਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਕਿਸ ਤਰੀਕੇ ਨਾਲ ਅਤੇ ਕਿਵੇਂ ਚਲਾਉਣਾ ਚਾਹੀਦਾ ਹੈ ਅਤੇ ਟੈਕਨੋਲੋਜੀ ਸਾਨੂੰ ਇਹ ਦੱਸਦੀ ਹੈ ਕਿ ਸਾਡੇ ਇਹ ਜ਼ਿੰਦਗੀ ਵਿੱਚ ਕਿਵੇਂ ਅੱਗੇ ਜਾ ਕੇ ਸਾਨੂੰ ਇਹ ਕੰਮ ਕਰੇਗਾ ਇਸ ਤਰ੍ਹਾਂ ਵਿਗਿਆਨ ਅਤੇ ਟੈਕਨੋਲੋਜੀ ਨੇ ਦੋਨਾਂ ਨੇ ਮਿਲ ਕੇ ਹੀ ਵਾਤਾਵਰਨ ਵਿੱਚ ਜੋ ਵੀ ਸੰਬੰਧਿਤ ਦੋਨਾਂ ਨਾਲ ਮਿਲ ਕੇ ਮੁੱਦੇ ਸਨ ਉਹਨਾਂ ਨੂੰ ਹੱਲ ਕਰਨ ਵਿੱਚ ਸਾਡੀ ਜੋ ਹੈ ਮਦਦ ਕੀਤੀ ਹੈ ਧੰਨਵਾਦ